ਹਾਂਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਅਤੇ ਇਤਿਹਾਸਕ ਸਥਾਨ ਹਨ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਹੈ ਇੱਥੇ ਘੁੰਮਣ ਵਾਸਤੇ ਆਮ ਖ਼ਾਸ ਬਾਗ਼ ਵੀ ਹੈ ਫਤਿਹਗੜ੍ਹ ਸਾਹਿਬ ਗੁਰਦੁਆਰੇ ਦਾ ਇਤਿਹਾਸ ਇਹ ਹੈ ਵਜ਼ੀਰ ਖ਼ਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨਾਂ ਲਈ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਅਤੇ ਉਸ ਤੋਂ ਬਾਅਦ ਵਜ਼ੀਰ ਖ਼ਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਮ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚਿਣਵਾ ਦਿੱਤਾ ਸੀ ਅਤੇ ਮਾਤਾ ਗੁਜਰੀ ਜੀ ਨੇ ਆਪਣਾ ਸਰੀਰ ਠੰਡੇ ਬੁਰਜ ਦੇ ਵਿੱਚ ਹੀ ਤਿਆਗ ਦਿੱਤਾ ਸੀ ਸ਼੍ਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਹੋਇਆ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਵੀ ਉੱਥੇ ਹੀ ਕੀਤਾ ਗਿਆ ਸੀ ਇੱਥੇ ਘੁੰਮਣ ਵਾਸਤੇ ਆਮ ਖ਼ਾਸ ਬਾਗ਼ ਵੀ ਹੈ ਲੋਕ ਅਕਸਰ ਆਪਣਾ ਖ਼ਾਲੀ ਸਮਾਂ ਬਿਤਾਉਣ ਆਮ ਖ਼ਾਸ ਬਾਗ਼ ਜਾਂਦੇ ਹਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਆਮ ਖ਼ਾਸ ਬਾਗ਼ ਅਤੇ ਹੋਰ ਵੀ ਕਈ ਥਾਵਾਂ ਹਨ ਅਤੇ ਕਿਸੇ ਦੀ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਲੋਕ ਆਪਣਾ ਖ਼ਾਲੀ ਸਮਾਂ ਜਦੋਂ ਵੀ ਲੋਕ ਆਪਣਾ ਖ਼ਾਲੀ ਸਮਾਂ ਦੇਖਦੇ ਹਨ ਤਾਂ ਉਹ ਆਮ ਖ਼ਾਸ ਬਾਗ਼ ਘੁੰਮਣ ਲਈ ਚਲੇ ਜਾਂਦੇ ਹਨ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰਮੀਸ਼ਨ ਨਹੀਂ ਲੈਣੀ ਪੈਂਦੀ